ਮੇਰੀ ਸਵੇਰ ਦੀ ਖ਼ੁਰਾਕ ਮਲਮ ਪਹਿਲਾਂ ਤਾਂ ਮੈਂ ਚਾਏ ਵਗੈਰਾ ਪੀਣਾ ਬਿਸਕੁਟ ਵਗੈਰਾ ਖਾਣਾ ਫੇਰ ਫੇਰ ਮੈਂ ਨੌ ਵਜੇ ਤੱਕ ਮਲਮ ਅ ਰੋਟੀ ਮਲਮ ਸਬਜ਼ੀ ਦਾਲ ਵਗੈਰਾ ਕੁਛ ਖਾ ਲੈਣਾ ਫਿਰ ਮੈਂ ਲੰਚ ਟਾਈਮ ਇੱਕ ਦੋ ਰੋਟੀ ਖਾ ਲੈਣੀ ਹੈ ਫੇਰ ਸ਼ਾਮ ਨੂੰ ਫਿਰ ਅਸੀਂ ਚਾਏ ਪੀਂਦੇ ਹੈ ਅਤੇ ਫੇਰ ਰਾਤ ਨੂੰ ਅਸੀਂ ਰੋਟੀ ਵਗੈਰਾ ਖਾਂਦੇ ਹਾਂ ਅਤੇ ਸਾਨੂੰ ਮਲਮ ਰੋਟੀ ਵਗੈਰਾ ਖਾਣ ਵਧੀਆ ਰੋਟੀ ਖਾਣ 'ਤੇ ਮਲਮ ਕੁਆਲਿਟੀ ਦੀ ਚੀਜ਼ ਖਾਣ 'ਤੇ ਸਾਡੇ ਸਿਹਤ 'ਤੇ ਬਹੁਤ ਹੀ ਵਧੀਆ ਅਸਰ ਹੁੰਦਾ ਅਤੇ ਸਾਡੀ ਸਿਹਤ ਚੰਗੀ ਰਹਿੰਦੀ ਹੈ ਅਤੇ ਲਾਈਫ਼ ਐਕਸਪੈਕਟੈਂਸੀ ਵੀ ਵੱਧਦੀ ਹੈ ਅਤੇ ਮਲਮ ਉਸਾਂ ਅਸੀਂ ਦੂ ਦੂਜਿਆਂ ਨੂੰ ਵੀ ਦੱਸਦੇ ਦਿੰਦੇ ਹਾਂ ਦੱਸਦੇ ਹਾਂ ਕਿ ਮਲਮ ਵਧੀਆ ਕੁਆਲਿਟੀ ਦਾ ਖਾਣਾ ਖਾਣ 'ਤੇ ਟਾਈਮ ਸਿਰ ਖਾਣਾ ਖਾਣ ਨਾਲ਼ ਮਲਮ ਬਹੁਤ ਵਧੀਆ ਮਲਮ ਸਿਹਤ ਰਹਿੰਦੀ ਹੈ ਅਸੀਂ ਬਿਮਾਰੀਆਂ ਤੋਂ ਵੀ ਦੂਰ ਰਹਿੰਦੇ ਹੈ ਅਤੇ ਚੌਲ ਦਾਲਾਂ ਵਗੈਰਾ ਸਾਨੂੰ ਮਲਮ ਘਰ ਘਰਾਂ 'ਚ ਹੀ ਬਹੁਤ ਵਧੀਆ ਮਿਲ ਜਾਂਦਾ ਅਤੇ ਕੁਆਲਿਟੀ ਦਾ ਮਲਮ ਸਮਾਨ ਖਾਂਦੇ ਹਾਂ ਕਿ ਮਲਮ ਵਧੀਆ ਹੋਵੇ ਮਲਮ ਸਿਹਤ ਠੀਕ ਰਹਿੰਦੀ ਇਹਦੇ ਨਾਲ਼ ਤਾਂ